ਵੇਖੋ ਜੀ ਪੌਦਿਆਂ ਵਿੱਚ ਲਗਾਈ ਜਾਣ ਵਾਲੀ ਮਿੱਟੀ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ ਜੋ ਕਿ ਚੀਕਣੀ ਮਿੱਟੀ ਹੁੰਦੀ ਹੈ ਇਹਦੇ ਨਾਲ ਪੌਦਾ ਚੰਗੀ ਤਰ੍ਹਾਂ ਵੱਧਦਾ ਫੁੱਲਦਾ ਰਹਿੰਦਾ ਹੈ ਅਤੇ ਇਹਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ ਕਿਉਂਕਿ ਮੇਨ ਮਿੱਟੀ ਦਾ ਹੀ ਮੰਨਿਆ ਜਾਂਦਾ ਹੈ ਕਿ ਜਿਹਦੇ ਨਾਲ ਬੂਟਾ ਬਹੁਤ ਵੱਡਾ ਹੋਵੇ ਉਹ ਤੁਹਾਡੀ ਸਹੀ ਮਿੱਟੀ ਹੋਣੀ ਚਾਹੀਦੀ ਹੈ ਮਿਲਾਵਟੀ ਰੇਤਲੀ ਮਿੱਟੀ ਨਹੀਂ ਹੋਣੀ ਚਾਹੀਦੀ ਅਤੇ ਬਾਕੀ ਅਸੀਂ ਖਾਦ ਆਪ ਤਿਆਰ ਕਰਦੇ ਹਾਂ ਅਸੀਂ ਰੈਡੀਮੇਡ ਖਾਦ ਨਹੀਂ ਯੂਜ਼ ਕਰਦੇ ਕਿਉਂਕਿ ਉਹ ਸਿਰਫ ਖਾਦ ਦੇ ਨਾਂ 'ਤੇ ਕੈਮੀਕਲ ਹੀ ਹੁੰਦੇ ਹਨ ਜੋ ਕਿ ਬੂਟੇ ਦਾ ਬਹੁਤ ਨੁਕਸਾਨ ਕਰਦੇ ਹਨ ਇਸ ਲਈ ਅਸੀਂ ਦੇਸੀ ਖਾਦ ਘਰ ਤਿਆਰ ਕਰਦੇ ਆ ਜਿਵੇਂ ਲਾ ਲਓ ਕਿ ਗੋਹਾ ਹੋ ਗਿਆ ਮੱਝਾਂ ਦਾ ਗੋਹਾ ਅਤੇ ਜਿਹੜੇ ਮੁਰਗੇ ਹੁੰਦੇ ਨੇ ਉਹਨਾਂ ਦੇ ਖੰਭ ਬਿੱਠਾਂ ਉਹਨਾਂ ਦੀਆਂ ਉਹ ਮਤਲਬ ਕਿ ਵਰਤੀ ਦੀਆਂ ਹਨ ਅਤੇ ਜਿਹਦੇ ਨਾਲ ਮਤਲਬ ਕਿ ਪੌਦੇ ਬਹੁਤ ਮਜ਼ਬੂਤ ਅਤੇ ਵਧੀਆ ਫਲਦੇ ਹਨ